ਭੰਗੜਾ ਪੰਜਾਬ ਅਤੇ ਪੰਜਾਬੀ ਨੌਜਵਾਨਾਂ ਦਾ ਮੁੱਖ ਨਾਚ ਹੈ ਲਗਭਗ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਪਾਇਆ ਜਾਂਦਾ ਹੈ ਜਿਹਨਾਂ ਵਿੱਚੋਂ ਵਿਸਾਖੀ ਦਾ ਮੇਲਾ ਪ੍ਰਮੁੱਖ ਹੈ ਜਦੋਂ ਕਿਸਾਨ ਆਪਣੀ ਫ਼ਸਲ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤਾਂ ਉਹ ਭੰਗੜਾ ਪਾਉਂਦੇ ਹਨ ਭੰਗੜਾ ਤਾਕਤ ਹਿੰਮਤ ਬਹਾਦਰੀ ਅਤੇ ਜੋਸ਼ ਨਾਲ ਭਰਪੂਰ ਨਾਚ ਹੈ ਢੋਲ ਇਸ ਨਾਚ ਦਾ ਮੁੱਖ ਸਾਜ ਹੈ ਅਤੇ ਢੋਲੀ ਭੰਗੜਾ ਪੇਸ਼ ਕਰਨ ਵਾਲੇ ਨੌਜਵਾਨਾਂ ਵਿਚਕਾਰ ਖੜ੍ਹਾ ਹੁੰਦਾ ਹੈ ਜਦੋਂ ਢੋਲ ਵੱਜਦਾ ਹੈ ਤਾਂ ਨੌਜਵਾਨ ਨੱਚਣ ਲੱਗ ਜਾਂਦੇ ਹਨ ਜਿਵੇਂ ਜਿਵੇਂ ਢੋਲ ਦੀ ਤਾਲ ਬਦਲਦੀ ਹੈ ਨੱਚਣ ਵਾਲੇ ਨੌਜਵਾਨਾਂ ਦੀਆਂ ਹਰਕਤਾਂ ਬਦਲਦੀਆਂ ਹਨ ਢੋਲ ਦੀ ਬੀਟ ਨਾਲ ਸਰੀਰ ਦੀਆਂ ਸਾਰੀਆਂ ਹਰਕਤਾਂ ਚੱਲਦੀਆਂ ਹਨ ਤਾਲ ਹੌਲੀ ਹੌਲੀ ਵਧਦੀ ਜਾਂਦੀ ਹੈ ਜਿਸ ਨਾਲ ਸਰੀਰ ਦੀਆਂ ਹਰਕਤਾਂ ਵੀ ਤੇਜ਼ ਹੁੰਦੀਆਂ ਹਨ ਅੱਜ ਕੱਲ੍ਹ ਭੰਗੜੇ ਨੇ ਵੱਖ ਵੱਖ ਨਾਚਾਂ ਦੀਆਂ ਮੁਦਰਾਵਾਂ ਨੂੰ ਅਪਣਾਇਆ ਹੈ ਜਿਸ ਨੇ ਇਸ ਦੇ ਸਟੇਜ ਰੂਪ ਨੂੰ ਜਨਮ ਦਿੱਤਾ ਹੈ ਭੰਗੜੇ ਦੇ ਪਹਿਰਾਵੇ ਵਿੱਚ ਚਾਦਰਾ ਕੁੜਤਾ ਕੁੜਤੀ ਉੱਪਰ ਰੰਗੀਨ ਕੁੜਤੀ ਤੁਰਲੇ ਵਾਲੀ ਪੱਗ ਅਤੇ ਹੱਥ ਵਿੱਚ ਕੋਕੇ ਵਾਲੀ ਡਾਂਗ ਇਸ ਨੂੰ ਚਾਰ ਚੰਦ ਲਗਾਉਂਦੀ ਹੈ ਭੰਗੜਾ ਕਿਸੇ ਵੀ ਖੁਸ਼ੀ ਦੇ ਮੌਕੇ ਉੱਤੇ ਪਾਇਆ ਜਾਂਦਾ ਹੈ ਜਿਵੇਂ ਕਿ ਵਿਆਹ ਸ਼ਾਦੀ ਵਿੱਚ ਬਰਾਤ ਵਿੱਚ ਭੰਗੜਾ ਬਰਾਤ ਤੁਰਨ ਲੱਗਿਆਂ ਭੰਗੜਾ ਪਾਇਆ ਜਾਂਦਾ ਹੈ ਜਾਂ ਜਾਗੋ ਵਿੱਚ ਵੀ ਭੰਗੜਾ ਪਾਇਆ ਜਾਂਦਾ ਹੈ ਕਿਸੇ ਦੇ ਜਨਮਦਿਨ ਮੌਕੇ ਉਸ ਪਾਰਟੀ ਉੱਤੇ ਵੀ ਭੰਗੜਾ ਕੀਤਾ ਜਾਂਦਾ ਹੈ ਇਸ ਕਰਕੇ ਭੰਗੜਾ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਬਹੁਤ ਹੀ ਪ੍ਰਸਿੱਧ ਲੋਕ ਨਾਚ ਹੈ ਅਤੇ ਇਸ ਨੂੰ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ